ਚਾਰ ਲੱਖ ਅੱਸੀ ਹਜ਼ਾਰ ਪੰਜ ਸੌ ਸਤਾਸੀ ਪੰਜ ਲੱਖ ਚਾਲ੍ਹੀ ਹਜ਼ਾਰ ਦੋ ਸੌ ਪਚਾਸੀ ਪੰਜ ਸੌ ਸੱਠ ਇੱਕ ਹਜ਼ਾਰ ਬਾਰ੍ਹਾਂ ਬਾਰ੍ਹਾਂ ਹਜ਼ਾਰ ਦੋ ਸੌ ਇੱਕੀ